ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਕਿਹੜੇ ਫਰੈਂਡ ਜੀ ਅੱਛਾ ਅੱਛਾ ਵਾ ਹਾਂਜੀ ਉਹਨਾਂ ਦਾ ਫੋਨ ਵੀ ਆਇਆ ਸੀ ਉਹਨਾਂ ਨੇ ਮੈਨੂੰ ਦੱਸਿਆ ਸੀ ਹਾਂਜੀ ਅੱਛਾ ਅੱਛਾ ਠੀਕ ਹੈ ਜੀ ਅੱਛਾ ਅੱਛਾ ਨੰਬਰ ਦਿੱਲੀ ਦਾ ਹੈ ਅਤੇ ਤੁਸੀਂ ਇੱਧਰ ਪੰਜਾਬ ਦਾ ਕਰਵਾਉਣਾ ਠੀਕ ਹੈ ਠੀਕ ਆ ਹੋ ਜਾਵੇਗਾ ਉਹ ਪਰ ਕੁਝ ਫੋਰਮੈਲਿਟਿਜ਼ ਨੇ ਅਤੇ ਇਸ ਲਈ ਸਾਨੂੰ ਵੇਖਣਾ ਪੈਣਾ ਕਿ ਫੋਰਮੈਲਿਟਿਜ਼ ਵਗੈਰਾ ਸਾਨੂੰ ਦੇਖਣੀਆਂ ਪੈਣੀਆਂ ਅਤੇ ਤੁਸੀਂ ਹੈ ਨਾ ਮੈਨੂੰ ਆਪਣੇ ਦੱਸ ਦਿਓ ਕਿ ਡੋਕੂਮੈਂਟ ਸਾਰੇ ਹੈਗੇ ਨੇ ਠੀਕ ਹੈ ਠੀਕ ਹੈ ਡੋਕੂਮੈਂਟਸ ਹੈਗੇ ਨੇ ਤਾਂ ਤੁਸੀਂ ਹੈ ਨਾ ਮੈਨੂੰ ਉਹਨਾਂ ਦੀ ਪਿਕਚਰਸ ਵੱਟਸਐਪ ਕਰ ਦਿਓ ਐਕਚੁਲੀ ਬਾਕੀ ਮੈਂ ਨਾ ਕਰੰਟ ਅਥੋਰਟੀਜ਼ ਦੇ ਨਾਲ ਮੈਂ ਗੱਲ ਕਰਕੇ ਤੁਹਾਨੂੰ ਮੈਂ ਦੱਸ ਦੇਵਾਂਗਾ ਹਾਂ ਠੀਕ ਹੈ ਠੀਕ ਹੈ ਬਾਕੀ ਉਹ ਹੋਰ ਕੋਈ ਗੱਲ ਤਾਂ ਨਹੀਂ ਹੈਗੀ ਪ੍ਰੋਬਲਮ ਮਤਲਬ ਕਿ ਆਪਣੇ ਗੱਡੀ ਦੀ ਸੱਚ ਉਮਰ ਉਮਰ ਕਿੰਨੀ ਹੈ ਉਹਦੀ ਹੋ ਗਈ ਗੱਡੀ ਦੀ ਠੀਕ ਹੈ ਠੀਕ ਹੈ ਠੀਕ ਹੈ ਮੈਂ ਦੇਖ ਲੈਂਦਾ ਗੱਲ ਕਰਕੇ ਕਰੰਟ ਅਥੋਰਟੀਜ਼ ਦੇ ਨਾਲ ਅਤੇ ਠੀਕ ਹੈ ਓਕੇ ਓਕੇ